ਪੰਜਾਬ ਜਿਹੜਾ ਆ ਭਾਰਤ ਦੇਸ਼ ਦਾ ਸਭ ਤੋਂ ਵੱਡਾ ਐਗਰੀਕਲਚਰ ਖੇਤਰ ਹੈ ਜਿਹਦੇ ਵਿੱਚ ਕਿ ਅਠਾਨਵੇਂ ਪਰਸੈਂਟ ਖੇਤੀਬਾੜੀ ਏਰੀਆ ਕਵਰ ਹੁੰਦਾ ਹੈ ਪੂਰੇ ਦੇਸ਼ ਦਾ ਪੰਜਾਬ ਦੇ ਵਿੱਚ ਜਿਹੜੀਆਂ ਇੰਡਸਟਰੀਜ਼ ਨੇ ਉਹ ਵੀ ਕਾਫੀ ਫੈਲੀਆਂ ਹੋਈਆਂ ਨੇ ਜਿਵੇਂ ਕਿ ਜਿਵੇਂ ਕਿ ਐਗਰੋ ਹੋਗੀ ਫੂਡ ਪ੍ਰੋਸੈਸਿੰਗ ਇੰਡਸਟਰੀ ਹੋ ਗਈਆਂ ਟਰੈਕਟਰ ਇੰਡਸਟਰੀਆਂ ਹੋ ਗਈਆਂ ਔਟੋ ਕੰਪੋਨੈਂਟ ਬਾਈਸਾਈਕਲ ਉਹਨਾਂ ਦੇ ਸਪੇਅਰ ਪਾਰਟਸ ਸਪੋਰਟਸ ਗੁੱਡਸ ਲਾਈਟਿੰਗ ਇੰਜੀਨੀਅਰਿੰਗ ਗੁਡਸ ਹੋ ਗਈਆਂ ਕੈਮੀਕਲ ਪ੍ਰੋਡਕਟ ਟੈਕਸਟਾਈਲ ਇਹ ਸਾਰੀਆਂ ਇੰਡਸਟਰੀਜ ਜਿਹੜੀਆਂ ਨੇ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਡਿਵੈਲਪ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਜਿਹੜੀ ਐਗਰੀਕਲਚਰ ਲੈਂਡ ਹੈਗੀ ਹੈ ਖੇਤੀਬਾੜੀ ਦੀ ਧਰਤੀ ਹੈਗੀ ਹੈ ਉਹਨੂੰ ਤੁਸੀਂ ਬਹੁਤ ਹੋਰ ਕੰਮਾਂ ਵਾਸਤੇ ਯੂਸ ਕਰ ਸਕਦੇ ਹੋ ਪੰਜਾਬ ਦੀ ਜਿਹੜੀ ਧਰਤੀ ਹੈ ਇੱਥੇ ਪਾਣੀ ਦੀ ਵੀ ਕਮੀ ਕੋਈ ਨਹੀਂ ਹੈਗੀ ਇਸ ਕਰਕੇ ਜਿਹੜੀ ਇੱਥੇ ਲਾਰਜ ਸਕੇਲ ਇੰਡਸਟਰੀਜ਼ ਡਿਵੈਲਪ ਹੋ ਸਕਦੀਆਂ ਨੇ ਹੋਰ ਵੀ ਦੂਸਰੀ ਗੱਲ ਇਹ ਹੈ ਕਿ ਇੱਥੇ ਜਿਹੜਾ ਆ ਬਹੁਤ ਤੇਜ਼ ਉਦਯੋਗੀਕਰਨ ਹੁੰਦਾ ਆ ਹੋ ਸਕਦਾ ਆ ਬਹੁਤ ਵੱਡੇ ਲੈਵਲ 'ਤੇ ਜਿਹੜੇ ਹੈ ਇੱਥੇ ਇੰਡਸਟਰੀਜ਼ ਨੂੰ ਡਿਵੈਲਪ ਕੀਤਾ ਜਾ ਸਕਦਾ ਹੈ ਵਪਾਰਕ ਜਿਹੜਾ ਸੱਭਿਆਚਾਰ ਹੈ ਭਾਰਤ ਦੇ ਦੂਜੇ ਖੇਤਰਾਂ ਨਾਲੋਂ ਪੰਜਾਬ ਦੇ ਵਿੱਚ ਉਹ ਸੌਖਾ ਹੈ